ਗਾਇਕੀ ਮਨੁੱਖੀ ਆਵਾਜ਼ ਦੀ ਵਰਤੋਂ ਦੁਆਰਾ ਸੰਗੀਤ ਧੁਨਾ ਪੈਦਾ ਕਰਨ ਨੂੰ ਕਹਿੰਦੇ ਹਨ ਗਾਉਣ ਵਾਲੇ ਮਨੁੱਖ ਨੂੰ ਗਾਇਕ ਜਾਂ ਗਾਇਕਾ ਕਿਹਾ ਜਾਂਦਾ ਹੈ ਉਹ ਆਪਣੇ ਫਨ ਰਾਹੀਂ ਗੀਤ ਗਾਉਣੇ ਨਗਮੇ ਵਗੈਰਾ ਵਰਗੀਆਂ ਕਲਾਵਾਂ ਦਾ ਮੁਜ਼ਾਰਾ ਕਰਦਾ ਹੈ ਗਾਇਕੀ ਦੀ ਸੰਗਤ ਵਿੱਚ ਸੰਗੀਤ ਦਾ ਹੋਣਾ ਜ਼ਰੂਰੀ ਹੈ ਨਾਲ ਇਨਕਲਾਬੀ ਪੰਜਾਬ ਦੇ ਲੋਕ ਸੰਗੀਤ ਹੋਰ ਲੋਕ ਕਲਾਵਾਂ ਵਾਂਗ ਸੰਗੀਤ ਵੀ ਇੱਕ ਲੋਕ ਕਲਾ ਹੈ ਜੋ ਹਰ ਕਲਾਵਾਂ ਵਾਂਗ ਮਨੁੱਖ ਦੀ ਕਿਰਤ ਪ੍ਰਕਿਰਿਆ ਰਾਹੀਂ ਵਜੂਦ ਵਿੱਚ ਆਈ ਇਹ ਮਨੁੱਖੀ ਮਨ ਨੂੰ ਖੇੜਾ ਉਤਸ਼ਾਹ ਅਤੇ ਆਤਮਿਕ ਅਨੰਦ ਬਖਸ਼ਦੀ ਹੈ ਧਾਰਮਿਕ ਦ੍ਰਿਸ਼ਟੀ ਤੋਂ ਇਨਸਾਨ ਇਨਸਾਨ ਇਸਨੂੰ ਅਤ ਆਤਮਾ ਅਤੇ ਪਰਮਾਤਮਾ ਨਾਲ ਮਿਲਣ ਦਾ ਸਾਧਨ ਵੀ ਮੰਨਿਆ ਜਾਂਦਾ ਹੈ ਇਸ ਲਈ ਸੰਗੀਤਕਾਰ ਗਾਇਕੀ ਨੂੰ ਇਹ ਇਬਾਦਤ ਮੰਨਦੇ ਹਨ ਪੰਜਾਬ ਦਾ ਸੰਗੀਤ ਵਿਰਸਾ ਅਤੇ ਵਿਕਾਸ ਡਾਕਟਰ ਦਰਸ਼ਨ ਸਿੰਘ ਨਰੂਲਾ ਪੰਜਾਬੀ ਰਾਈਟਰਸ ਕੋਪਰੇਟਿਵ ਇੰਡਸਟਿਲ ਸੁਸਾਇਟੀ ਲਿਮਿਟਿਜ਼ ਨਵੀਂ ਦਿੱਲੀ ਤੋਂ ਇਤਿਹਾਸ ਲੋਕ ਸੰਗੀਤ ਪੰਜਾਬ ਦੇ ਲੋਕ ਸੰਗੀਤ ਪੰਜਾਬੀ ਲੋਕ